ਜੋ ਕਿ ਜੀ ਪੀ ਐਸ ਘੜੀਆਂ ਹੈ ਜਿਵੇਂ ਕਿ ਅਲੱਗ ਅਲੱਗ ਕੰਪਨੀ ਦੀਆਂ ਹੈ ਕੋਈ ਐਮ ਆਈ ਦੀ ਹੈ ਜਾਂ ਐਪਲ ਦੀ ਹੈ ਜਾਂ ਹੋਰ ਕਈ ਕੰਪਨੀਆਂ ਦੇ ਵਿੱਚ ਇਹ ਉਪਲੱਬਧ ਹੈ ਮਾਰਕੀਟ ਦੇ ਵਿੱਚ ਇਸ ਦੀ ਵਰਤੋਂ ਜਿਵੇਂ ਅੱਜ ਕੱਲ੍ਹ ਟਰੈਂਡ ਚੱਲਿਆ ਹੋਇਆ ਕਿ ਗੁੱਟ ਦੇ ਉੱਪਰ ਬੰਨ੍ਹਦੇ ਹਾਂ ਘੜੀ ਤਾਂ ਅਸੀਂ ਰੋਜ਼ਾਨਾ ਕਿੰਨੇ ਸਟੈੱਪ ਵੋਕ ਕੀਤਾ ਹੈ ਚੱਲ ਕੇ ਆਏ ਹਾਂ ਉਹ ਵੀ ਉਹ ਕਾਊਂਟ ਕਰਦੀ ਹੈ ਸਾਡੀ ਹਾਰਟਬੀਟ ਵੀ ਕਾਊਂਟ ਕਰਦੀ ਹੈ ਤਾਂ ਸਾਡੀ ਪਲਸ ਰੇਟ ਵੀ ਸਾਨੂੰ ਦੱਸਦੀ ਹੈ ਤਾਂ ਇਹ ਜੋ ਘੜੀਆਂ ਹੈ ਜੀ ਪੀ ਐਸ ਜਾਂ ਆਰਟੀਫਿਸ਼ਲ ਇੰਟੈਲੀਜਸ ਹੀ ਅਸੀਂ ਕਹਿ ਸਕਦੇ ਆ ਦੀ ਇਹ ਸਾਨੂੰ ਜੋ ਵੀ ਅਸੀਂ ਰੋਜ਼ਾਨਾ ਆਪਣੇ ਰੂਟੀਨ ਵਿੱਚ ਕਰਦੇ ਹਾਂ ਉਹ ਉਹਦਾ ਜੋ ਪ੍ਰਦਰਸ਼ਨ ਹੈ ਉਨਦੀ ਜੋ ਪਰਫੋਰਮੈਂਸ ਹੈ ਉਹ ਸਾਨੂੰ ਆਪਣੀ ਸਕਰੀਨ ਦੇ ਉੱਪਰ ਦੱਸਦੀ ਹੈ ਉਸ ਤੋਂ ਇਲਾਵਾ ਜੋ ਸਾਡੇ ਜੋ ਰੋਜ਼ਾਨਾ ਦੇ ਜੋ ਹੁੰਦੇ ਨੇ ਸਿਹਤ ਟੀਚੇ ਜਿਵੇਂ ਕਿ ਅੱਜ ਮੈਂ ਦੋ ਹਜ਼ਾਰ ਸਟੈੱਪ ਚੱਲਣਾ ਹੈ ਜਾਂ ਤਿੰਨ ਹਜ਼ਾਰ ਜਾਂ ਪੰਜ ਹਜ਼ਾਰ ਸਟੈੱਪ ਚੱਲਣਾ ਤਾਂ ਜੇ ਉਹ ਕਿਤੇ ਘੱਟ ਰਹਿ ਜਾਂਦੇ ਆ ਤਾਂ ਅਸੀਂ ਉਸ ਜੀ ਪੀ ਇਸ ਘੜੀ ਨੂੰ ਦੇਖ ਕੇ ਵੀ ਇਹ ਅੱਜ ਇੰਨੇ ਕਾਊਂਟ ਹੋਏ ਨੇ ਇੰਨੇ ਸਟੈੱਪ ਘੱਟ ਨੇ ਜਾਂ ਵੱਧ ਨੇ ਤਾਂ ਅਸੀਂ ਉਸੇ ਹਿਸਾਬ ਨਾਲ ਉਸ ਟੀਚੇ ਨੂੰ ਪੂਰਾ ਕਰ ਸਕਦੇ ਹੈ ਨਾ ਤਾਂ ਉਸ ਤੋਂ ਇਲਾਵਾ ਜਿਵੇਂ ਕਿ ਸਾਡਾ ਪਲਸ ਰੇਟ ਜਾਂ ਬੀਪੀ ਬਲੱਡ ਪਰੈਸ਼ਰ ਜੋ ਹੈ ਕੀ ਕਿੰਨਾ ਇਸ ਟਾਈਮ ਹੈ ਜਾਂ ਕਿੰਨਾ ਇਹਨੂੰ ਅਸੀਂ ਮੇਨਟੇਨ ਕਰਨਾ ਹੈ ਹੈ ਨਾ ਬਣਾ ਕੇ ਰੱਖਣਾ ਤਾਂ ਉਹ ਸਾਰੀਆਂ ਚੀਜ਼ਾਂ ਵੀ ਅਸੀਂ ਉਸ ਚੀਜ਼ ਤੋਂ ਦੇਖਦੇ ਹਾਂ ਤਾਂ ਜਿਹਦੇ ਕਿ ਮਤਲਬ ਸਿਹਤ ਲਈ ਕਾਫੀ ਠੀਕ ਹੈ ਕਿਉਂਕਿ ਸਾਨੂੰ ਆਪਣੀ ਸਿਹਤ ਦਾ ਸਾਡੀ ਬੋਡੀ ਦਾ ਜੋ ਸਰੀਰ ਦਾ ਟੈਂਪਰੇਚਰ ਪਤਾ ਲੱਗਦਾ ਰਹਿੰਦਾ ਸਾਡੀ ਹਾਰਟ ਰੇਟ ਪਤਾ ਲੱਗਦੀ ਰਹਿੰਦੀ ਹੈ ਪਲਸ ਰੇਟ ਪਤਾ ਲੱਗਦਾ ਰਹਿੰਦਾ ਸਟੈੱਪ ਕਾਊਂਟ ਪਤਾ ਲੱਗਦਾ ਰਹਿੰਦਾ ਕਿ ਜਿਹਦੇ ਨਾਲ ਸਾਨੂੰ ਇੱਕ ਅਲੱਗ ਤੋਂ ਇੱਕ ਹੋਰ ਟਾਰਗੇਟ ਟੀਚਾ ਜੋ ਮਿਲ ਜਾਂਦਾ ਹੈ ਕਿ ਅਸੀਂ ਆਪਣੀ ਸਿਹਤ ਨੂੰ ਹੋਰ ਕਿਵੇਂ ਮੇਨਟੇਨ ਕਰ ਸਕਦੇ ਹਾਂ ਜਾਂ ਆਪਣੇ ਆਪ ਨੂੰ ਕਿਵੇਂ ਬੈਲੰਸ ਰੱਖ ਸਕਦੇ ਹਾਂ ਤਾਂ ਉਹ ਉਸ ਪੁਆਇੰਟ ਔਫ ਵਿਊ ਤੋਂ ਲੈ ਕੇ ਜੀ ਪੀ ਐਸ ਘੜੀਆਂ ਦੀ ਬੜੀ ਅੱਛੀ ਵਰਤੋਂ ਹੈ ਜਿਹਦੇ ਨਾਲ ਲੋਕ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਹੋਏ ਹੈ ਤਾਂ ਇਸ ਤਰ੍ਹਾਂ ਦੇ ਜੋ ਪ੍ਰੋਡਕਟ ਨੇ ਇਲੈਕਟ੍ਰੋਨਿਕਸ ਪ੍ਰੋਡਕਟ ਹੈ ਜੋ ਕਿ ਉਹ ਮਾਰਕੀਟ ਦੇ ਵਿੱਚ ਆਉਣੇ ਚਾਹੀਦੇ ਹੈ ਕਿਉਂਕਿ ਇਸ ਨਾਲ ਕਿ ਹਰ ਇਕ ਬੰਦਾ ਜੋ ਕਿ ਘੱਟ ਰੇਟਾਂ ਦੇ ਵੀ ਹੋਣੇ ਚਾਹੀਦੇ ਹੈ ਤਾਂ ਕਿ ਹਰੇਕ ਇਨਸਾਨ ਗਰੀਬ ਅਮੀਰ ਉਸ ਉਸ ਚੀਜ਼ ਨੂੰ ਜਾਂ ਉਸ ਘੜੀ ਨੂੰ ਖਰੀਦਣ ਦੇ ਲਈ ਸਮਰੱਥ ਹੋਵੇ ਤਾਂ ਤਾਂ ਜੋ ਉਹ ਆਪਣੀ ਸਿਹਤ ਦਾ ਵੀ ਉਸ ਜੀ ਪੀ ਐਸ ਘੜੀਆਂ ਦੇ ਮਾਧਿਅਮ ਰਾਹੀਂ ਆਪਣੇ ਆਪ ਨੂੰ ਅਪਡੇਟ ਕਰ ਰੱਖੇ ਕਰ ਸਕੇ ਅਤੇ ਆਪਣੀ ਸਿਹਤ ਦਾ ਜੋ ਹੈ ਕੀ ਹੈ ਧਿਆਨ ਰੱਖ ਸਕੀਏ ਤਾਂ ਇਹਦਾ ਜੋ ਜੀ ਪੀ ਐਸ ਘੜੀਆਂ ਦਾ ਹੈ ਬੜਾ ਅੱਛੀਆਂ ਇਹ ਇਹਨਾਂ ਦੀ ਪਰਫੋਰਮਸ ਹੈ ਧੰਨਵਾਦ